ਹਰ ਰਾਜ ਦੇ ਲੋਕਾਂ ਨੂੰ ਵੈਸੇ ਤਾਂ ਮੈਂ ਪੰਜਾਬ ਦੀ ਵਾਸੀ ਹਾਂ ਅਤੇ ਬਜਾਏ ਕਿ ਬਾਕੀ ਰਾਜਾਂ ਦਾ ਭੂਗੋਲ ਪੜ੍ਹਨ ਦੀ ਥਾਂ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਸਟੇਟ ਦੇ ਭੂਗੋਲ ਬਾਰੇ ਭੂਮੀ ਬਾਰੇ ਪਤਾ ਹੋਣਾ ਚਾਹੀਦਾ ਵੀ ਮੇਰੇ ਪੰਜਾਬ ਰਾਜ ਹੈ ਉਸਦੀ ਭੂਮੀ ਕਿਵੇਂ ਦੀ ਹੈ ਕਿਸ ਚੀਜ਼ ਦੇ ਲਈ ਅਸੀਂ ਇਸ ਦਾ ਵਿਕਾਸ ਕਰ ਸਕਦੇ ਹਾਂ ਇਹ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਆ